ਪੰਜਾਬ ਦਾ ਸੱਭਿਆਚਾਰ ਬਹੁਤ ਜ਼ਿਆਦਾ ਵਧੀਆ ਹੈਗਾ ਇਹ ਸਾਨੂੰ ਜਿਹੜਾ ਹੈਗਾ ਸਾਡੀ ਵਿਰਾਸਤ ਦੇ ਵਿੱਚੋਂ ਮਿਲਿਆ ਸਾਨੂੰ ਆਪਣੇ ਸੱਭਿਆਚਾਰ ਨੂੰ ਜਿਹੜਾ ਹੈਗਾ ਸੰਭਾਲ ਕੇ ਰੱਖਣਾ ਚਾਹੀਦਾ ਇਹਨੂੰ ਸੰਭਾਲਣ ਦੇ ਵਾਸਤੇ ਅਸੀਂ ਜਿਹੜੇ ਹੈਗੇ ਹਾਂ ਬਹੁਤ ਜ਼ਿਆਦਾ ਉਪਰਾਲੇ ਕਰ ਸਕਦੇ ਹਾਂ ਉਹਦੇ ਵਾਸਤੇ ਅਸੀਂ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਜਿਹੜੇ ਹੈਗੇ ਆ ਸਾਡੇ ਦਾਦਾ ਦਾਦੀ ਜਾਂ ਉਹਨਾਂ ਤੋਂ ਵੀ ਵੱਡਾ ਬਜ਼ੁਰਗ ਪਿੰਡ ਦੇ ਵਿੱਚ ਕੋਈ ਹੈਗਾ ਤਾਂ ਅਸੀਂ ਉਹਨਾਂ ਕੋਲ ਜਾ ਸਕਦੇ ਹਾਂ ਉਹਨਾਂ ਤੋਂ ਅਸੀਂ ਆਪਣੇ ਸੱਭਿਆਚਾਰ ਬਾਰੇ ਪੁੱਛ ਸਕਦੇ ਹੈਗੇ ਹਾਂ ਸਾਡੇ ਪੁਰਾਣੇ ਤਿਉਹਾਰ ਕਿਹੇ ਜਿਹੇ ਸੀ ਸਾਡੇ ਲੋਕ ਪਹਿਲਾਂ ਰਹਿੰਦੇ ਸਹਿੰਦੇ ਕਿਵੇਂ ਸੀ ਉਹਨਾਂ ਦਾ ਕੀ ਸੱਭਿਆਚਾਰ ਸੀ ਉਹਨਾਂ ਦਾ ਕੀ ਪਛੋਕੜ ਸੀਗਾ ਅਸੀਂ ਉਹਨਾਂ ਤੋਂ ਜਾਣ ਕੇ ਉਹਨਾਂ ਦੇ ਉੱਪਰ ਅਸੀਂ ਬੁੱਕਸ ਛਾਪ ਸਕਦੇ ਹਾਂ ਫਿਲਮ ਬਣਾ ਸਕਦੇ ਹਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਜਾਂ ਸਹਿਰਾਂ ਦੇ ਵਿੱਚ ਜਾ ਕੇ ਅਸੀਂ ਨੁੱਕੜ ਨਾਟਕ ਜਿਹੜੇ ਹੈਗੇ ਆ ਕਰ ਸਕਦੇ ਹਾਂ ਜਿਸ ਨਾਲ ਅਸੀਂ ਆਪਣਾ ਸੱਭਿਆਚਾਰ ਆ ਜਿਹੜਾ ਉਹਨੂੰ ਬਚਾ ਸਕਦੇ ਹੈਗੇ ਹਾਂ ਅਸੀਂ ਜਿਵੇਂ ਸਾਡਾ ਪੁਰਾਣਾ ਸੱਭਿਆਚਾਰ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਤਿਉਹਾਰ ਮਨਾਉਂਦੇ ਸੀ ਵਿਆਹ ਸ਼ਾਦੀਆਂ ਅਸੀਂ ਕਿਸ ਤਰ੍ਹਾਂ ਸੱਭਿਆਚਾਰਕ ਰਸਮਾਂ ਦੇ ਨਾਲ ਕਰਦੇ ਸੀ ਅਸੀਂ ਉਹਨਾਂ ਨੂੰ ਫਿਰ ਤੋਂ ਜਿਉਂ ਜਿਉਂਦਾ ਰੱਖ ਸਕਦੇ ਹੈਗੇ ਐਗੇ ਆਪਾਂ ਬਜ਼ੁਰਗਾਂ ਕੋਲੋਂ ਪੁੱਛ ਕੇ ਆਪਾਂ ਹੁਣ ਆਪਣੀ ਲਾਇਫ ਦੇ ਵਿੱਚ ਉਹ ਬਣਾ ਸਕਦੇ ਹੈਗੇ ਹਾਂ ਜਾਂ ਅਸੀਂ ਜਿਹੜੇ ਹੈਗੇ ਆ ਮਿਊਜ਼ੀਅਮ ਬਣਾ ਸਕਦੇ ਹੈਗੇ ਹਾਂ ਜਿੱਥੇ ਸਾਨੂੰ ਇਹ ਸਾਰਾ ਕੁਛ ਦੇਖਣ ਨੂੰ ਮਿਲੇ ਉਹਨਾਂ ਦੇ ਉੱਪਰ ਲਿਖਿਆ ਹੋਵੇ ਵੀ ਕੀ ਸੱਭਿਆਚਾਰ ਇਹਦਾ ਪਹਿਲਾਂ ਦਾ ਇਤਿਹਾਸ ਕੀ ਸੀ ਇਹ ਕਿੱਥੋਂ ਆਇਆ ਕਿਵੇਂ ਆਇਆ ਅਸੀਂ ਇਹ ਸਾਰਾ ਕੁਛ ਉੱਥੋਂ ਜਿਹੜਾ ਹੈਗਾ ਜਾਣ ਸਕਦੇ ਹਾਂ ਅਸੀਂ ਜਿਹੜੀ ਹੈਗੀ ਐਗੀ ਇਹ ਸਾਡੀ ਇੱਕ ਛੋਟੀ ਜਿਹੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਸਾਡੇ ਜਿਹੜੇ ਸੱਭਿਆਚਾਰ ਨੂੁੰ ਹੈਗੀ ਹੈ ਜਿਹੜੀ ਉਹ ਬਚਾ ਕੇ ਰੱਖ ਸਕਦੀ ਹੈ ਜਿੰਦਾ ਰੱਖ ਸਕਦੀ ਹੈ ਉਸਨੂੰ ਕੋਸ਼ਿਸ਼ ਉਹ ਕੋਸ਼ਿਸ਼ ਸਾਨੂੰ ਜਿਹੜੀ ਹੈਗੀ ਹੈ ਜਾਰੀ ਰੱਖਣੀ ਪਊਗੀ ਉਹਦੇ ਵਾਸਤੇ ਸਾਨੂੰ ਜਿਹੜੀ ਹੈਗੀ ਐਗੀ ਆਪਣੇ ਬਜ਼ੁਰਗਾਂ ਦੇ ਨਾਲ ਗੱਲ ਬਾਤ ਕਰਨੀ ਪਊਗੀ ਪਿੰਡਾਂ ਦੇ ਵਿੱਚ ਸੈਮੀਨਾਰ ਕਰਨੇ ਪੈਣਗੇ ਸਾਨੂੰ ਸੱਥਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਜਾਣਾ ਪਊਗਾ ਅਤੇ ਸਾਨੂੰ ਇੱਕ ਦੂਜੇ ਦੇ ਨਾਲ ਕਿਵੇਂ ਗੱਲ ਬਾਤ ਕਰਨੀ ਹੈ ਸਾਰਾ ਕੁਛ ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਇਹ ਹੀ ਸਿੱਖ ਕੇ ਅਸੀਂ ਜਿਹੜਾ ਹੈਗਾ ਆਪਣਾ ਸੱਭਿਆਚਾਰ ਜਿਹੜਾ ਹੈਗਾ ਗਾ ਉਹ ਬਚਾ ਸਕਦੇ ਹਾਂ